ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਮੈਂ ਕਿਹਾ ਆਪਣੀ ਮੇਰੀ ਕਨੇਡਾ ਦੀ ਫਲੈਟ ਸੀਗੀ ਕੱਲ੍ਹ ਨੂੰ ਦੋ ਵਜੇ ਅਤੇ ਦਸ ਕੁ ਵਜੇ ਮੇਰੇ ਕੋਲ ਪਹੁੰਚ ਜਿਓ ਵੀ ਤੁਸੀਂ ਕਿੰਨੇ ਕੁ ਟਾਈਮ ਤੋਂ ਕਿੰਨੇ ਕੁ ਟਾਈਮ ਮੇਰੇ ਕੋਲ ਪਹੁੰਚ ਜਾਓਗੇ ਤੁਸੀਂ ਵੀ ਦੋ ਵਜੇ ਦੀ ਫਲੈਟ ਆ ਮੇਰੀ ਕਪੂਰਥਲੇ ਮੇਨ ਬਾਜ਼ਾਰ ਹਨੂੰਮਾਨ ਮੰਦਿਰ ਦੇ ਕੋਲ ਸੱਜੀ ਸਾਈਡ ਨੂੰ ਆਪਣਾ ਘਰ ਆ ਭਾਅ ਜੀ ਅਤੇ ਬਾਰਾਂ ਵਜੇ ਮੇਰੀ ਦੋ ਵਜੇ ਮੇਰੀ ਫਲੈਟ ਹੈ ਭਾਅ ਜੀ ਮੈਂ ਮਨਾਲੀ ਓ ਇੱਥੇ ਓ ਮੋਹਾਲੀ ਤੋਂ ਮੋਹਾਲੀ ਏਅਰਪੋਰਟ ਤੋਂ ਚੜ੍ਹਨਾ ਆ ਮੋਹਾਲੀ ਏਅਰਪੋਰਟ ਤੋਂ ਚੜ੍ਹਨਾ ਇੱਥੇ ਕਨੇਡਾ ਦੀ ਮੇਰੀ ਫਲੈਟ ਆ ਭਾਅ ਜੀ ਆਪਣੇ ਤੁਸੀਂ ਕਿੰਨੇ ਟਾਈਮ ਪਹਿਲਾਂ ਮੇਰੇ ਤੋਂ ਗੱਡੀ ਤੁਸੀਂ ਕਿੰਨੇ ਟਾਈਮ ਪਹਿਲਾਂ ਮੇਰੇ ਤੋਂ ਪਹੁੰਚ ਜਾਓਗੇ ਭਾਅ ਜੀ ਤੁਸੀਂ ਮੇਰੇ ਕੋਲ ਮੇਰੇ ਕੋਲ ਕਿੰਨੇ ਟਾਈਮ ਪਹਿਲਾਂ ਪਹੁੰਚ ਜਾਓਗੇ ਵੀ ਆਪਣੇ ਉਸ ਹਿਸਾਬ ਨਾਲ ਵੀ ਇੱਥੇ ਏਅਰਪੋਰਟ 'ਤੇ ਵੀ ਬਾਰਾਂ ਵਜੇ ਸਾ ਸਾਢੇ ਬਾਰਾਂ ਵਜੇ ਮੇਰੀ ਐਂਟਰੀ ਆ ਉੱਥੇ ਏਅਰਪੋਰਟ 'ਤੇ ਵੀ ਤੁਸੀਂ ਕਿੰਨਾ ਟਾਈਮ ਮੇਰੇ ਤੋਂ ਪਹਿਲਾਂ ਦਸ ਵਜੇ ਤੋਂ ਪਹਿਲਾਂ ਪਹਿਲਾਂ ਮੇਰੇ ਕੋਲ ਪਹੁੰਚ ਜਾਓਗੇ ਹਾਂਜੀ ਭਾਅ ਜੀ ਮੈਨੂੰ ਦਸ ਕੁ ਵਜੇ ਤੋਂ ਪਹਿਲਾਂ ਪਹਿਲਾਂ ਮੇਰੇ ਕੋਲ ਪਹੁੰਚ ਜਾਇਓ ਫਿਰ ਹਿਸਾਬ ਨਾਲ ਉੱਥੇ ਪਹੁੰਚਣਾ ਬਾਰਾਂ ਸਾਢੇ ਕੁ ਬਾਰਾਂ ਮੇਰੀ ਐਂਟਰੀ ਆ ਭਾਅ ਜੀ ਉੱਥੇ ਫਿਰ ਤੁਹਾਨੂੰ ਪਤਾ ਉੱਥੇ ਟਾਈਮ ਲੱਗ ਜਾਂਦਾ ਆ ਮੂਹਰੇ ਟਿ ਟਿਕਟ ਟੁੱਕਟ ਦਿਖਾਉਣ ਨੂੰ ਸਭ ਤੋਂ ਮੂਹਰੇ ਟਾਈਮ ਲੱਗ ਜਾਂਦਾ ਭਾਅ ਜੀ ਅਤੇ ਤੁਸੀਂ ਮੇਰੇ ਤੋਂ ਟਾਈਮ ਨਾਲ ਭਾਅ ਜੀ ਮੇਰੇ ਤੋਂ ਪਹੁੰਚ ਜਾਇਓ ਵੀ ਸਾਢੇ ਬਾਰਾਂ ਵਜੇ ਮੇਰੀ ਐਂਟਰੀ ਆ ਠੀਕ ਆ ਭਾਅ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਭਾਅ ਜੀ